ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹਦੇ ਵਾਸਤੇ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਸਾਨੂੰ ਉਸਨੂੰ ਇੱਕ ਅਜਿਹੇ ਸਵੱਛ ਵਾਤਾਵਰਨ ਦੇ ਵਿੱਚ ਰੱਖੀਏ ਕਿ ਉਹ ਕਦੇ ਵੀ ਕਿਸੇ ਵੀ ਬਿਮਾਰੀ ਗ੍ਰਸਤ ਦੇ ਵਿੱਚ ਗ੍ਰਸਤ ਨਾ ਹੋਵੇ ਬਿਮਾਰ ਨਾ ਹੋਵੇ ਪਰ ਉਹਦੇ ਲਈ ਜ਼ਰੂਰੀ ਹੈ ਕਿ ਸਾਨੂੰ ਉਸਦੇ ਆਲੇ ਦੁਆਲੇ ਦੇ ਵਿੱਚ ਪੂਰੀ ਜਿੱਥੇ ਵੀ ਬੱਚੇ ਨੂੰ ਅਸੀਂ ਰੱਖ ਰਹੇ ਹਾਂ ਉੱਥੇ ਸਾਫ ਸਫਾਈ ਹੋਣੀ ਚਾਹੀਦੀ ਹੈ ਉਸ ਨੂੰ ਜੋ ਸੰਭਾਲਣ ਵਾਲਾ ਹੈ ਉਸਦੀ ਕੇਅਰ ਕਰਨ ਵਾਲੀ ਉਸਦੀ ਮਾਂ ਹੈ ਜਾਂ ਹੋਰ ਕੋਈ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕਰ ਰਹੇ ਹਨ ਹੈਲਪਰ ਹੈ ਕੋਈ ਰਿਸ਼ਤੇਦਾਰ ਹੈ ਤਾਂ ਉਹ ਬੜੇ ਸਾਫ ਸੁਥਰੇ ਉਹਨਾਂ ਦੇ ਆਪਣਾ ਪਹਿਰਾਵਾ ਵਧੀਆ ਸਾਫ ਸੁਥਰੇ ਧੋਤੇ ਕੱਪੜੇ ਪਾਏ ਹੋਣੇ ਚਾਹੀਦੇ ਹਨ ਸਾਫ ਸੁਥਰੇ ਉਹਨਾਂ ਦਾ ਰਹਿਣ ਸਹਿਣ ਚੰਗਾ ਹੋਣਾ ਚਾਹੀਦਾ ਹੈ ਬੱਚੇ ਨੂੰ ਉਹਨਾਂ ਨੇ ਜਦੋਂ ਸੰਭਾਲਣਾ ਹੈ ਤਾਂ ਆਪਣੇ ਹੱਥਾਂ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਫ ਸਫਾਈ ਦੇ ਵਿੱਚ ਉਹਨਾਂ ਨੂੰ ਰਹਿਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਇਹੋ ਜਿਹੀ ਕੋਈ ਵਾਤਾਵਰਨ ਨਾ ਦਿੱਤਾ ਮਿਲੇ ਕਿ ਜਿਹਦੇ ਕਾਰਨ ਉਹ ਬਿਮਾਰ ਹੋ ਜਾਵੇ ਸਮੇਂ ਸਮੇਂ 'ਤੇ ਉਸ ਦੀ ਡੋਕਟਰ ਵੀ ਕੇਅਰ ਕਰੇ ਆਪ ਮਾਂ ਵੀ ਕੇਅਰ ਕਰੇ ਮਾਂ ਆਪਣੀ ਵੀ ਕੇਅਰ ਕਰੇ ਅਤੇ ਅਜਿਹਾ ਕਰਕੇ ਹੀ ਅਸੀਂ ਬੱਚੇ ਨੂੰ ਇੱਕ ਵਧੀਆ ਵਾਤਾਵਰਨ ਦੇ ਸਕਦੇ ਹਾਂ ਤਾਂ ਕਿ ਬੱਚਾ ਕਦੇ ਵੀ ਸਾਡੇ ਵੱਲੋਂ ਕੋਈ ਅਜਿਹੀਆਂ ਸਥਿਤੀਆਂ ਨਾ ਪੈਦਾ ਹੋਣ ਜਿਹਦੇ ਕਾਰਨ ਬੱਚਾ ਬਿਮਾਰ ਹੋ ਜਾਵੇ ਇਸ ਲਈ ਸਾਡੀ ਬੱਚੇ ਦੇ ਪ੍ਰਤੀ ਇੱਕ ਫਰਜ਼ ਵੀ ਹੈ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਜੋ ਬੱਚਾ ਜਨਮ ਲੈ ਰਿਹਾ ਹੈ ਉਸਨੂੰ ਇੱਕ ਵਧੀਆ ਵਾਤਾਵਰਨ ਅਸੀਂ ਦਈਏ ਵਾਤਾਵਰਨ ਸਾਡਾ ਧਾਰਮਿਕ ਵੀ ਹੋਣਾ ਚਾਹੀਦਾ ਹੈ ਸਾਡਾ ਜਿਹਦੇ ਨਾਲ ਬੱਚੇ ਦੀ ਪਰਸਨੈਲਿਟੀ ਵਧੀਆ ਬਣੀ ਰਹੇ ਅਤੇ ਪੂਰੀ ਲਾਈਫ ਉਸਦੀ ਵਧੀਆ ਲੰਘੇ